ਕੁਛ ਸਾਲਾਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਮਨੋਰੰਜਨ ਦਾ ਦ੍ਰਿਸ਼ ਕੁਛ ਵੱਖਰਾ ਹੀ ਸੀ ਅਤੇ ਹੁਣ ਜੋ ਸਮਾਂ ਚੱਲ ਰਿਹਾ ਉਸਦਾ ਦ੍ਰਿਸ਼ ਕੁਛ ਵੱਖਰਾ ਹੀ ਹੈ ਕੁਛ ਸਾਲ ਪਹਿਲਾਂ ਲੋਕ ਘਰ ਹੀ ਘਰ ਵਿੱਚ ਹੀ ਖੇਡਦੇ ਸਨ ਜਿਵੇਂ ਕਿ ਆਊਟਡੋਰ ਗੇਮਾਂ ਹੋ ਗਈਆਂ ਅਤੇ ਇੰਨਡੋਰ ਗੇਮਾਂ ਹੋ ਗਈਆਂ ਆਊਟਡੋਰ ਵਿੱਚ ਉਹ ਲੁੱਕਣ ਮਾਟੀ ਬਰਫ ਪਾਣੀ ਬੜਾ ਕੁਛ ਖੇਡਦੇ ਸਨ ਘਰ ਬੈਠੇ ਵੀ ਬੰਦਾ ਖੇਡ ਸਕਦਾ ਸੀ ਬਟ ਅੱਜ ਦਾ ਦ੍ਰਿਸ਼ ਤੁਸੀਂ ਵੇਖ ਹੀ ਸਕਦੇ ਹੋ ਬੱਚੇ ਅੱਜ ਕੱਲ੍ਹ ਆਪਣੇ ਫੋਨ 'ਚ ਕਿੰਨੇ ਵੜੇ ਰਹਿੰਦੇ ਹਨ ਫੋਨਾਂ 'ਤੇ ਲੈਪਟਾਪ 'ਤੇ ਅਤੇ ਟੈਪ 'ਤੇ ਉਹ ਅੱਜ ਕੱਲ੍ਹ ਉਹ ਚੀਜ਼ ਨਹੀਂ ਖੇਡਦੇ ਜੋ ਕਿ ਪੰਜਾਬ ਵਿੱਚ ਪਹਿਲਾਂ ਹੁੰਦੀਆਂ ਸਨ ਜੋ ਕਿ ਪਹਿਲੇ ਬੱਚੇ ਖੇਡਦੇ ਸਨ ਗੇਮਾਂ ਹੋ ਗਈਆਂ ਪਰ ਅੱਜ ਕੱਲ੍ਹ ਬੱਚੇ ਆਪਣੇ ਘਰੋਂ ਬਾਹਰ ਨਿਕਲਣ ਨੂੰ ਹੀ ਨਹੀਂ ਤਿਆਰ ਹਨ ਉਹ ਬਸ ਫੋਨ 'ਚ ਹੀ ਵੜੇ ਰਹਿੰਦੇ ਹਨ ਉਹ ਅਸ ਉਹ ਕਿਤੇ ਬਾਹਰ ਵੀ ਜਾਣ ਟਰੈਵਲਿੰਗ ਕਰਨ ਕਿਤੇ ਵੀ ਘੁੰਮਣ ਜਾਣ ਆਪਣੇ ਪਰਿਵਾਰ ਨਾਲ ਅਤੇ ਦੋਸਤਾਂ ਨਾਲ ਉਹ ਚੋਵੀਸ ਘੰਟੇ ਫੋਨ 'ਚ ਹੀ ਵੜੇ ਰਹਿੰਦੇ ਹਨ ਸਾਨੂੰ ਸਾਰਿਆਂ ਨੂੰ ਆਪਣੇ ਪੰਜਾਬ ਦੇ ਮਨੋਰੰਜਨ ਪਹਿਲੇ ਮਨੋਰੰਜਨ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅਤੇ ਸਾਨੂੰ ਸਾਰਿਆਂ ਨੂੰ ਉਹ ਅੱਗੇ ਵਧਾਉਣਾ ਚਾਹੀਦਾ ਸਾਨੂੰ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਕਿ ਉਹ ਫੋਨ ਨੂੰ ਛੱਡ ਕੇ ਕੁਛ ਬਾਹਰ ਵੀ ਘੁੰਮਣ ਕੁਛ ਸਿੱਖਣ ਉਹ ਕਿਤੇ ਗਏ ਹੈ ਕੁਛ ਪੜ੍ਹਨ ਵਾਲੀਆਂ ਚੀਜ਼ਾਂ ਵੇਖਣ ਗੇਮਾਂ ਖੇਡਣ ਬਾਕੀ ਦੋਸਤਾਂ ਨਾਲ ਬਟ ਉਹ ਅੱਜ ਕੱਲ੍ਹ ਗੇਮਾਂ ਹੀ ਖੇਡਦੇ ਦਿਸਦੇ ਹਨ ਜਿਵੇਂ ਕਿ ਪੱਬਜੀ ਹੋ ਗਿਆ ਫਰੀ ਫਾਇਰ ਹੋ ਗਈ ਬਸ ਇਹਨਾਂ ਚੀਜ਼ਾਂ ਨੇ ਲੋਕਾਂ ਦਾ ਬੱਚਿਆਂ ਦਾ ਭਵਿਸ਼ਯ ਖਰਾਬ ਕਰ ਦਿੱਤਾ